ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਜੀ ਮੈਂ ਇਹ ਆਪਣੇ ਸਕੂਲ ਦੇ ਵਿੱਚ ਨਿਊ ਹੈ ਨਿਊ ਜੋਇਨਿੰਗ ਕੀਤੀ ਹੋਈ ਹੈ ਜੀ ਮੈਂ ਇਸ ਸਕੂਲ ਦੀਆਂ ਪੋਲਸੀਜ ਬਾਰੇ ਪੁੱਛਣਾ ਸੀ ਜੀ ਸਕੂਲ ਵਧੀਆ ਲੱਗਿਆ ਜੀ ਮਤਲਬ ਕਿ ਬੱਚੇ ਵੀ ਸਾਰੇ ਵਧੀਆ ਜੀ ਰਸਪੈਕਟ ਕਰਦੇ ਹੈ ਟੀਚਰ ਦੀ ਬਾਕੀ ਹਜੇ ਤਾਂ ਜੀ ਮੇਰੀ ਜੋਆਇਨਿੰਗ ਹੀ ਹੈ ਬਾਕੀ ਮੈਨੂੰ ਹੋਲੀ ਹੋਲੀ ਪਤਾ ਲੱਗੂਗਾ ਜੀ ਇਸ ਲਈ ਤੁਸੀਂ ਮੈਨੂੰ ਮਤਲਬ ਕਿ ਸਕੂਲ ਬਾਰੇ ਪੋਲਸੀਜ ਵਗੈਰਾ ਬਾਰੇ ਦੱਸ ਦੋ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮਤਲਬ ਕੇ ਜਿਹੜਾ ਵੀਕਲੀ ਟੈਸਟ ਹੋਊ ਹਫ਼ਤੇ ਬਾਅਦ ਟੈਸਟ ਲੈਣਾ ਜੀ ਉਸ ਦੇ ਵਿੱਚ ਜੋ ਹਫ਼ਤੇ ਵਿੱਚ ਪੜ੍ਹਾਇਆ ਹੋਊਗਾ ਸਿਰਫ਼ ਓਨਾ ਕੀ ਪਾ ਸਕਦੇ ਕਿ ਮਤਲਬ ਕਿ ਕੁਛ ਨੋਲੇਜ ਵਗੈਰਾ ਦੇ ਵੀ ਪ੍ਰਸ਼ਨ ਪਾ ਸਕਦੇ ਹੈ ਜੀ ਹਾਂਜੀ ਹੋ ਮਤਲਬ ਕਿ ਜੁਆਕ ਬੱਚਿਆਂ ਵਾਸਤੇ ਹੋਰ ਹਾਂਜੀ ਹਾਂਜੀ ਮਤਲਬ ਫਿਰ ਬੱਚਿਆਂ ਦਾ ਪ੍ਰੈਕਟੀਕਲ ਵਰਕ ਕਿਵੇਂ ਹੁੰਦਾ ਜੀ ਲੈਬ 'ਚ ਵਗੈਰਾ ਹਾਂਜੀ ਹਾਂਜੀ ਮਤਲਬ ਕਿ ਜਿਹੜਾ ਆਪਾਂ ਵੀਕਲੀ ਟੈਸਟ ਵਗੈਰਾ ਲੈਨੇ ਆਂ ਤੇ ਉਹ ਮਾਕਸ ਵਗੈਰਾ ਤੁਸੀਂ ਮਤਲਬ ਕਿ ਡਿਸਾਈਡ ਕਰਦੇ ਆਂ ਦੱਸਦੇ ਆਂ ਵੀ ਐਨੇ ਮਾਕਸ ਦਾ ਪਾ ਸਕਦੇ ਆਂ ਟੈਸਟ ਕੇ ਮਤਲਬ ਕਿ ਸੀ ਮਤਲਬ ਕਿ ਮੈਂ ਹੁਣ ਮੈਨੂੰ ਇਸ ਸਕੂਲ ਦੇ ਮਤਲਬ ਕਿ ਰੂਲਜ ਨਹੀਂ ਪਤਾ ਨੀ ਜੀ ਹੈਗੇ ਤੋ ਫਿਰ ਤਾਂ ਕਰਕੇ ਫੇਰ ਤੁਸੀਂ ਮੈਨੂੰ ਦੱਸ ਦੋ ਜੀ ਹਾਂਜੀ

ਹਾਂਜੀ ਹਾਂਜੀ ਮਤਲਬ ਕਿ ਜੇ ਕੋਈ ਬੱਚਾ ਬਿਹੇਵ ਟੀਚਰ ਦੇ ਨਾਲ ਵਿਵਹਾਰ ਸਈ ਨਹੀਂ ਕਰਦਾ ਉਨ੍ਹਾਂ ਉਸ ਦੀ ਕੰਪਲੇਂਟ ਵੀ ਤੁਹਾਡੇ ਕੋਲ ਕਰ ਸਕਦੇ ਹਾਂ ਨਾ ਜੀ